ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਜੀ ਹਾਂਜੀ ਮਦਰ ਬੋਲ ਰਹੀ ਹਾਂ ਜੀ ਮੈਂ ਉਹਦੀ ਹੈਪੀ ਦੀ ਮਦਰ ਨਹੀਂ ਜੀ ਉਹਨਾਂ ਨੇ ਤਾਂ ਕੁਛ ਨਹੀਂ ਦੱਸਿਆ ਹੈਪੀ ਨੇ ਤਾਂ ਸਾਨੂੰ ਅੱਛਿਆ ਜੀ ਘਰ ਤਾਂ ਕੋਈ ਗੱਲ ਨਹੀਂ ਹੋਈ ਜੀ ਨਹੀਂ ਜੀ ਸਾਨੂੰ ਤਾਂ ਕੋਈ ਗੱਲ ਨਹੀਂ ਸੀ ਦੱਸੀ ਉਹਨੇ ਹਾਂਜੀ ਅੱਛਿਆ ਜੀ ਐੱਮ ਐੱਸ ਟੀ ਦੇ ਹੋਏ ਸੀ ਪੇਪਰ ਹੁਣ ਉਹ ਤਾਂ ਖੇਡਾਂ 'ਚ ਹੀ ਫਿਰਦਾ ਖੇਡਾਂ ਵਿੱਚ ਬਹੁਤਾ ਧਿਆਨ ਦਿੰਦਾ ਖੇਡਦਾ ਹੀ ਹੈ ਉਹ ਤਾਂ ਠੀਕ ਹੈ ਜੀ ਹਾਂਜੀ ਹਾਂਜੀ ਬਸ ਖਾਣਾ ਪੀਣਾ ਖਾਇਆ ਤਾਂ ਖੇਡਣ ਲੰਘ ਜਾਂਦਾ ਹੈ ਤਾਂ ਘੰਟਾ ਕੁ ਪੜ੍ਹਾਈ ਕਰ ਲੈਂਦਾ ਉਸ ਵਿੱਚੋਂ ਠੀਕ ਹੈ ਜੀ ਨਹੀਂ ਜੀ ਕੋਈ ਨਹੀਂ ਆਉਂਦਾ ਇਹਨੂੰ ਸਮਝਾਉਂਦੇ ਹਾਂ ਨਾਲੇ ਇਹਦਾ ਟਿਊਸ਼ਨ ਵਗੈਰਾ ਦਾ ਇੰਤਜ਼ਾਮ ਕਰਦੇ ਹਾਂ ਟਿਊਸ਼ਨ ਅੱਛਾ ਜੀ ਸਰ ਸਾਨੂੰ ਤਾਂ ਸਾਨੂੰ ਤਾਂ ਇਸ ਬਾਰੇ ਵੀ ਨਹੀਂ ਨਾ ਪਤਾ ਸੀਗਾ ਠੀਕ ਹੈ ਜੀ ਕੋਈ ਨਹੀਂ ਸਰ ਜੀ ਐਂ ਆਂ ਇਹਨੂੰ ਕਹਾਂਗੇ ਧਿਆਨ ਰੱਖਾਂਗੇ ਸਰ ਜੀ ਕੋਈ ਨਹੀਂ ਤੁਹਾਡਾ ਧੰਨਵਾਦ ਫੋਨ ਕਰਨ ਦਾ ਸਾਨੂੰ ਦੱਸਣ ਦਾ ਹਾਂਜੀ ਠੀਕ ਹੈ ਸਰ ਜੀ ਓਕੇ